ਭਾਰਤ ਦੀ ਆਜ਼ਾਦੀ ਦੀ ਲਹਿਰ ਕਾਫੀ ਲੰਬਾ ਸਮਾਂ ਚੱਲੀ ਕਾਫੀ ਲੰਬਾ ਸਮਾਂ ਦੇ ਵਿੱਚ ਬਹੁਤ ਸਾਰੇ ਲੋਕ ਸੀ ਜਿਹੜੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਰਤ ਦੀ ਅਜ਼ਾਦੀ ਦੀ ਲਹਿਰ ਹੈ ਜਿਹੜੀ ਉਹਦੇ ਵਿੱਚ ਬੱਚਿਆਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸਾਰਿਆਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਇਸ ਸਾਰੇ ਇਸ ਸਹਿਯੋਗ ਦੇ ਵਿੱਚ ਉਨ੍ਹਾ ਨੇ ਬਹੁਤ ਸਾਰੇ ਆਪਣੇ ਸਰੀਰਾਂ ਉੱਤੇ ਕਸ਼ਟ ਵੀ ਝੱਲੇ ਤਾਂ ਕਿਤੇ ਜਾ ਕੇ ਅੰਤ ਨੂੰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਸਾਡਾ ਦੇਸ਼ ਸੀ ਜਿਹੜਾ ਉਹ ਅੰਗਰੇਜ਼ਾਂ ਦੇ ਹੱਥੋਂ ਅਜ਼ਾਦ ਹੋਇਆ ਇਸ ਆਜ਼ਾਦੀ ਭਾਰਤ ਦੀ ਆਜ਼ਾਦੀ ਦੇ ਵਿੱਚ ਕਈ ਬੱਚੇ ਬਜ਼ੁਰਗ ਜਿੱਦਾਂ ਕਿ ਮਹਾਤਮਾ ਗਾਂਧੀ ਲਾਲਾ ਲਾਜਪਤ ਰਾਏ ਇਨ੍ਹਾਂ ਨੂੰ ਕਈ ਵਾਰੀ ਜੇਲ੍ਹ ਦੀ ਹਵਾ ਵੀ ਖਾਣੀ ਪਈ ਇਸ ਤੋਂ ਬਿਨਾ ਨੌਜਵਾਨਾਂ ਦੇ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਇਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਹੈ ਜਿਹੜਾ ਉਹ ਪਾਇਆ ਅਤੇ ਅੰਤ ਨੂੰ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਜੇ ਇਸ ਇਹ ਜਲ੍ਹਿਆਂ ਵਾਲੇ ਬਾਗ ਦੀ ਦਾ ਸਾਕਾ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਵੀ ਬੱਚੇ ਬਜ਼ੁਰਗ ਕੋਲੋਂ ਅਸੀਂ ਸੁਣ ਸਕਦੇ ਹਾਂ ਇਸ ਤਰ੍ਹਾਂ ਭਾਰਤ ਦੀ ਆਜ਼ਾਦੀ ਨੂੰ ਬਹੁਤ ਸਾਰੇ ਲੋਕਾਂ ਦੀ ਦੇਣ ਤੋਂ ਬਾਅਦ ਆਜ਼ਾਦੀ ਦੀ ਪ੍ਰਾਪਤੀ ਹੋਈ